ਹੈਲੋ ਅਸੀਂ ਬਾਹਰ ਤੋਂ ਆਏ ਹੋਏ ਮੈਡਮ ਅਤੇ ਮੈਨੂੰ ਦੱਸ ਦਿਓ ਕਿਵੇਂ ਇੱਥੇ ਮਿਲੇਗਾ ਸਥਾਨ ਕਿੱਥੇ ਜਾਈਏ ਘੁੰਮਣ ਵਾਸਤੇ

ਅੱਛਾ ਧਾਰਮਿਕ ਸਥਾਨ ਕਿਹੜੇ ਕਿਹੜੇ ਹੈਗੇ ਨੇ ਅਤੇ ਆਪਾਂ ਕਿਵੇਂ ਜਾ ਸਕਦੇ ਐਂ ਫਿਰ ਸਾਨੂੰ ਤੋਂ ਟੈਕਸੀ ਵਗੈਰਾ ਕਾਰ ਕੋਈ ਵਹੀਕਲ ਲੈ ਕੇ ਦਓਂਗੇ ਕਿੰਨੇ ਪੈਸੇ ਕਿੰਨੇ ਲੱਗ ਜਾਣਗੇ ਅੱਛਾ ਜੀ ਹੋਰ ਹੋਰ ਇੱਥੇ ਪਾਰਕ ਕਿਹੜੇ ਕਿਹੜੇ ਹੈਗੇ ਨੇ ਅਤੇ ਹਾਂਜੀ ਹਾਂਜੀ ਆਉ ਅਸੀਂ ਅੱਜ ਇੱਥੇ ਬਾਰਡਰ ਵੀ ਦੇਖਣਾ ਸੀ ਕਹਿੰਦੇ ਨੇ ਫਾਜ਼ਿਲਕਾ ਦਾ ਬਾਰਡਰ ਬੜਾ ਮਸ਼ਹੂਰ ਏ ਵੈਸੇ ਸਾਡੇ ਸਾਡੇ ਵਹੀਕਲ ਦਾ ਪ੍ਰਬੰਧ ਕਰ ਦਿਓ ਤਾਂ ਅਸੀਂ ਚੱਲਦੇ ਰਹਾਂਗੇ ਤੁਹਾਡੇ ਨਾਲ ਠੀਕ ਹੈ